ਮਹਾਨ ਸੰਤੋਲ ਵਜੋਂ ਖੇਡਾਂ ਦੀ ਭੂਮਿਕਾ ਨੂੰ ਮਹੱਤਵਪੂਰਨ ਤੌਰ 'ਤੇ ਦੇਖਿਆ ਜਾ ਸਕਦਾ ਹੈ ਜਿਸ ਨਾਲ ਕਿ ਸਮਾਜ ਅਤੇ ਧਾਰਮਿਕ ਵਖਰੇਵਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ ਉਦਾਹਰਨ ਵਜੋਂ ਸਾਡੇ ਦੇਸ਼ ਵਿੱਚ ਜੋ ਖੇਡ ਸਿਸਟਮ ਹੈ ਬੜਾ ਵਧੀਆ ਬਣਾਇਆ ਗਿਆ ਹੈ ਜੋ ਕਿ ਜੋਨ ਲੈਵਲ ਤੋਂ ਸ਼ੁਰੂ ਹੋ ਕੇ ਅੰਤਰਰਾਸ਼ਟਰੀ ਪੱਧਰ ਤੱਕ ਜਾਂਦਾ ਹੈ ਜਿਸ ਵਿੱਚ ਵੱਖ ਵੱਖ ਧਰਮਾਂ ਦੇ ਬੱਚੇ ਇਕੱਠੇ ਹੋ ਕੇ ਇੱਕ ਟੀਮ ਵਜੋਂ ਪਹਿਲਾਂ ਤਾਂ ਜੋਨਲ ਤੌਰ 'ਤੇ ਫਿਰ ਜ਼ਿਲ੍ਹੇ ਦੇ ਤੌਰ 'ਤੇ ਫਿਰ ਨੈਸ਼ਨਲ ਤੌਰ 'ਤੇ ਅਤੇ ਇਸ ਤਰ੍ਹਾਂ ਹੀ ਅੰਤਰਰਾਸ਼ਟਰੀ ਪੱਧਰ 'ਤੇ ਫਿਰ ਦੇਸ਼ ਵੱਲੋਂ ਵੀ ਖੇਡਣ ਜਾਂਦੇ ਹਨ ਦੇਸ਼ ਦੀ ਟੀਮ ਵਿੱਚ ਵੀ ਵੱਖ ਵੱਖ ਧਰਮਾਂ ਦੇ ਖਿਡਾਰੀ ਸ਼ਾਮਿਲ ਹੁੰਦੇ ਹਨ ਜਿਸ ਨਾਲ ਕਿ ਸਾਡੇ ਦੇਸ਼ ਦੀ ਤਰੱਕੀ ਦਾ ਰਾਹ ਖੁੱਲ੍ਹਦਾ ਹੈ